ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਕਿ ਖਾਲੀ ਸਮੇਂ ਵਿੱਚ ਮੈਂ ਆਪਣਾ ਮਨੋਰੰਜਨ ਕਿਵੇਂ ਕਰਦੀ ਹਾਂ ਅਤੇ ਮਨੋਰੰਜਨ ਦੇ ਕੇ ਕਈ ਸਾਧਨ ਹਨ ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਇੱਕ ਜਗ੍ਹਾ ਇਕੱਠੇ ਹੋ ਕੇ ਨੱਚਦੇ ਟੱਪਦੇ ਸਨ ਅਤੇ ਹੁਣ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਅਤੇ ਲੋਕ ਇਕੱਠੇ ਬੈਠਣਾ ਘੱਟ ਪਸੰਦ ਕਰਦੇ ਹਨ ਪਰ ਹੁਣ ਨਵੇਂ ਜ਼ਮਾਨੇ ਵਿੱਚ ਨਵੀਆਂ ਚੀਜ਼ਾਂ ਆ ਗਈਆਂ ਹਨ ਜਿਵੇਂ ਮੋਬਾਈਲ ਟੀ ਵੀ ਨਵੀਆਂ ਗੇਮਾਂ ਆਦਿ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਖਾਲੀ ਸਮੇਂ ਵਿੱਚ ਮੈਂ ਜ਼ਿਆਦਾਤਰ ਟੀ ਵੀ ਦੇਖਣਾ ਪਸੰਦ ਕਰਦੀ ਹਾਂ ਟੀ ਵੀ ਦੇ ਵਿੱਚ ਕੋਈ ਨਾਟਕ ਜਾਂ ਫਿਰ ਕੋਈ ਧਾਰਮਿਕ ਸੀਰੀਅਲ ਜਿੱਦਾਂ ਰਮਾਇਣ ਮਹਾਂਭਾਰਤ ਆਦਿ ਅਤੇ ਕਦੇ ਕਦੇ ਅਸੀਂ ਆਪਣੇ ਪਰਿਵਾਰ ਦੇ ਨਾਲ ਇਕੱਠੇ ਬਹਿ ਕੇ ਕੋਈ ਪੰਜਾਬੀ ਫਿਲਮ ਵੀ ਦੇਖ ਲੈਂਦੇ ਹਾਂ ਕਦੇ ਕਦੇ ਅਸੀਂ ਟੀ ਵੀ ਉੱਤੇ ਗਾਣੇ ਵੀ ਸੁਣਦੇ ਹਨ ਜੇ ਜੋ ਸੁਣਦੇ ਹਾਂ ਸਵੇਰੇ ਸਵੇਰੇ ਮੈਂ ਟੀ ਵੀ ਵਿੱਚ ਭਜਨ ਲਗਾ ਦਿੰਦੀ ਹਾਂ ਅਤੇ ਜੇ ਮੈਂ ਗੱਲ ਕਰਾਂ ਕਿ ਮੇਰੇ ਹੋਰ ਮਨੋਰੰਜਨ ਦੇ ਸਾਧਨ ਕੀ ਹਨ ਉਹ ਇਹ ਹਨ ਕਿ ਜਿਵੇਂ ਮੈਂ ਕਦੇ ਲੁੱਡੋ ਵਾਲੀ ਗੇਮ ਖੇਡ ਲੈਂਦੀ ਹਾਂ ਜਿਸ ਵਿੱਚ ਜ਼ਿਆਦਾਤਰ ਮੈਂ ਜਿੱਤ ਰਹੀ ਹਾਂ ਮੈਂ ਤੁਹਾਨੂੰ ਇਸ ਦ ਇਹ ਦੱਸਾਂਗੀ ਕਿ ਲੁੱਡੋ ਵਾਲੀ ਗੇਮ ਖੇਡਣ ਲਈ ਅੱਜ ਕੱਲ੍ਹ ਸਾਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਫੋਨ ਵਿੱਚ ਹੀ ਖੇਡਦੇ ਹਾਂ ਅਤੇ ਕਦੇ ਕਦੇ ਖਾਲੀ ਸਮੇਂ ਵਿੱਚ ਮੈਂ ਫੋਨ ਉੱਤੇ ਰੇਡੀਓ ਲਗਾ ਕੇ ਗਾਣੇ ਸੁਣਦੀ ਹਾਂ ਅਤੇ ਮੈਂ ਕਦੇ ਕਦੇ ਵਿਹਲੇ ਟਾਈਮ ਵਿੱਚ ਇੱਦਾਂ ਦੀ ਇੱਦਾਂ ਹੀ ਅਖ਼ਬਾਰ ਪੜ੍ਹ ਲੈਂਦੀ ਹਾਂ ਅਤੇ ਜਾਂ ਆਪਣੀ ਸਹੇਲੀ ਨਾਲ ਗੱਲ ਕਰ ਲੈਂਦੀ ਹਾਂ ਧੰਨਵਾਦ